ਹਾਂਜੀ ਬਹੁਤ ਸਾਰੀਆਂ ਬਾਈਕਸ ਹੁੰਦੀਆਂ ਨੇ ਜਿਵੇਂ ਕਿ ਸਪਲੈਂਡਰ ਪਲਸਰ ਕੇ ਟੀ ਐਮ ਪਰ ਮੇਰੇ ਕੋਲ ਹਜੇ ਸਿਰਫ਼ ਹੀਰੋ ਹਾਂਡਾ ਹੀ ਹੈ ਪਰ ਜਿਹੜੀ ਮੇਰੀ ਡਰੀਮ ਬਾਈਕ ਆ ਉਹ ਆ ਬੁਲਟ ਅਤੇ ਉਹ ਕਾਫ਼ੀ ਕੰਫਰਟੇਬਲ ਬਾਈਕ ਆ ਮੈਨੂੰ ਬਹੁਤ ਪਸੰਦ ਆ ਉਹ ਅਤੇ ਮੈਨੂੰ ਬਹੁਤ ਹੀ ਆਰਾਮਦਾਇਕ ਅਤੇ ਬੜੀ ਪਸੰਦ ਲੱਗਦੀ ਉਹ ਦੇਖਣ 'ਚ ਵੀ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਖਾਸ ਕਰ ਕਾਲੇ ਰੰਗ ਦਾ ਬੁਲਟ ਮੈਨੂੰ ਬਹੁਤ ਸੋਹਣਾ ਲੱਗਦਾ ਅਤੇ ਮੈਂ ਮੇਰੀ ਹਜੇ ਹ ਆਰਥਿਕ ਆਰਥਿਕ ਹਾਲਤ ਠੀਕ ਨਹੀਂ ਆ ਕਿ ਮੈਂ ਉਹ ਬੁਲਟ ਨੂੰ ਖਰੀਦ ਸਕਾਂ ਪਰ ਜਦੋਂ ਵੀ ਮੇਰੇ ਕੋਲ ਪੈਸੇ ਆਉਣਗੇ ਜਾਂ ਫਿਰ ਜਦੋਂ ਵੀ ਮੈਨੂੰ ਮੌਕਾ ਮਿਲੇਗਾ ਤਾਂ ਮੈਂ ਉਹ ਬੁਲਟ ਹੀ ਖਰੀਦੂੰਗੀ ਕਿਉਂਕਿ ਮੇਰਾ ਇਹ ਡਰੀਮ ਆ ਕਿ ਮੈਂ ਆਪਣੇ ਬੁਲਟ 'ਤੇ ਹੀ ਕਿਤੇ ਵੀ ਜਾਵਾਂ ਘੁੰਮਾ ਅਤੇ ਉਹਦੇ 'ਤੇ ਹੀ ਸਾਰਾ ਕੁਝ ਸਫ਼ਰ ਕਰਾਂ ਕਿਉਂਕਿ ਉਹ ਮੈਨੂੰ ਬਹੁਤ ਬਹੁਤ ਜ਼ਿਆਦਾ ਪਸੰਦ ਹੈ